ਅਸੀਂ ਬਗੀਚੇ ਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਬਗੀਚੇ ਵਿੱਚ ਪੌਦਿਆਂ ਨੂੰ ਬਹੁਤ ਬਿਮਾਰੀਆਂ ਲੱਗਦੀਆਂ ਹਨ ਇਸ ਲਈ ਬਗੀਚੇ ਦੀ ਸਾਂਭ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ ਬਾਗ ਵਿੱਚ ਫੁੱਲ ਅਤੇ ਫਲਾਂ ਦੇ ਪੌਦੇ ਲਗਾਏ ਜਾਂਦੇ ਹਨ ਇਹਨਾਂ ਪੌਦਿਆਂ ਨੂੰ ਮੌਸਮ ਅਨੁਸਾਰ ਖਾਦਾਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਲਾ ਲਓ ਤੁਸੀਂ ਪੌਦਿਆਂ ਦੇ ਪੱਤੇ ਪੀਲੇ ਪੈ ਜਾਂਦੇ ਹਨ ਇਹਨਾਂ ਦੇ ਪੱਤੇ ਸੁੱਕ ਕੇ ਝੜ ਜਾਂਦੇ ਹਨ ਜਾਂ ਇਹਨਾਂ ਪੌਦਿਆਂ ਦੇ ਵਿਕਾਸ ਵਿੱਚ ਕੋਈ ਵਾਧਾ ਨਹੀਂ ਹੁੰਦਾ ਫਲ ਅਤੇ ਫੁੱਲ ਨਾ ਲੱਗਣ ਤਾਂ ਵੀ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਪੌਦਿਆਂ ਦੇ ਕੀੜੇ ਮਕੌੜੇ ਪੱਤਿਆਂ ਨੂੰ ਖਾਣ ਲੱਗ ਜਾਂਦੇ ਹਨ ਬਗੀਚੇ ਵਿੱਚ ਮੱਛਰ ਦੀ ਵੀ ਪੈਦਾ ਹੋ ਜਾਂਦੇ ਹਨ ਕਿਉਂਕਿ ਬਗੀਚੇ ਵਿੱਚ ਹਰਿਆਲੀ ਅਤੇ ਪਾਣੀ ਹੁੰਦਾ ਹੈ ਇਸ ਲਈ ਸਪਰੇ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਸਾਨੂੰ ਬਗੀਚੇ ਦੀ ਸਾਂਭ ਸੰਭਾਲ ਸਮੇਂ ਸਮੇਂ ਸਿਰ ਕਰਨੀ ਚਾਹੀਦੀ ਹੈ ਬਗੀਚੇ ਵਿੱਚ ਪਾਣੀ ਦੀ ਵੀ ਵਰਤੋਂ ਸਮੇਂ ਸਿਰ ਕਰਨੀ ਚਾਹੀਦੀ ਹੈ